ਅਹ ਸਭ ਤੋਂ ਪਹਿਲਾਂ ਤਾਂ ਜੇ ਮੈਂ ਗੱਲ ਕਰਾਂ ਕਿ ਕਿਸ ਜਗ੍ਹਾ 'ਤੇ ਗਿਆ ਮੈਂ ਗਿਆ ਸੀ ਸਭ ਤੋਂ ਪਹਿਲਾਂ ਆਪਣੇ ਅੰਮ੍ਰਿਤਸਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਉੱਥੇ ਸਭ ਤੋਂ ਜੋ ਮਹੱਤਵਪੂਰਨ ਅਤੇ ਸਭ ਤੋਂ ਅਨੰਦਮਈ ਗੱਲ ਇਹ ਹੈ ਕਿ ਜਦੋਂ ਅਸੀਂ ਉੱਥੇ ਐਂਟਰ ਕਰਦੇ ਹਾਂ ਕਿਤੇ ਸੰਗਤਾਂ ਤਾਂ ਹਜ਼ਾਰਾਂ ਦੇ ਰੂਪ ਦੇ ਵਿੱਚ ਹੁੰਦੀਆਂ ਲੇਕਿਨ ਉੱਥੋਂ ਦਾ ਜੋ ਵਾਤਾਵਰਨ ਹੈ ਸ਼ਾਂਤ ਇੰਨਾ ਹੁੰਦਾ ਕਿ ਜਿਵੇਂ ਅਸੀਂ ਖੁਦ ਰੱਬ ਨੂੰ ਮਿਲ ਰਹੇ ਐ ਇੰਨਾਂ ਉੱਥੇ ਸ਼ਾਂਤ ਮਾਹੌਲ ਹੁੰਦਾ ਗੁਰਬਾਣੀ ਚੱਲ ਰਹੀ ਹੁੰਦੀ ਹੈ ਲੋਕ ਇੱਧਰ ਉੱਧਰ ਜਾ ਰਹੇ ਆ ਕੋਈ ਲੋਕ ਦਰਸ਼ਨਾਂ ਲਈ ਲਾਈਨ ਦੇ ਵਿੱਚ ਲੱਗੇ ਹੋਏ ਹੈ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਜੋ ਗੁਰੂ ਦਾ ਲੰਗਰ ਉੱਥੇ ਫਰੀ ਆਫ ਕੋਸਟ ਸਭ ਨੂੰ ਮਿਲਦਾ ਹੈ ਬਿਨਾਂ ਕਿਸੇ ਧਰਮ ਦੇ ਭੇਦਭਾਵ ਤੋਂ ਜਾਤੀ ਭੇਦਭਾਵ ਤੋਂ ਬਿਨਾਂ ਉਹ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਅਨੰਦਮਈ ਚੀਜ਼ ਹੈ ਕਿ ਜੋ ਉਹ ਗੁਰੂ ਦਾ ਲੰਗਰ ਹੈ ਹਮੇਸ਼ਾ ਚੌਵੀ ਘੰਟੇ ਜੋ ਉੱਥੇ ਚਲਦਾ ਅਤੇ ਜੋ ਵੀ ਸੰਗਤ ਦਰਸ਼ਨਾਂ ਲਈ ਉੱਥੇ ਆਉਂਦੀ ਹੈ ਮੱਥਾ ਟੇਕ ਕੇ ਗੁਰੂ ਦੇ ਦਰਸ਼ਨ ਕਰਕੇ ਉਸ ਤੋਂ ਬਾਅਦ ਉਹ ਆਪਣੇ ਲੰਗਰ ਹਾਲ ਦੇ ਜਾਂਦੇ ਆ ਲੰਗਰ ਖਾਣ ਲਈ ਉਸ ਤੋਂ ਬਾਅਦ ਰੱਬ ਦਾ ਸ਼ੁਕਰਾਨਾ ਕਰਕੇ ਫਿਰ ਉਹ ਆਪਣੇ ਮੰਜ਼ਿਲਾਂ ਵੱਲ ਵਧਦੇ ਹੈ ਸਭ ਤੋਂ ਜੋ ਮੈਨੂੰ ਅਨੰਦਮਈ ਚੀਜ਼ ਲੱਗੀ ਹੈ ਕਿ ਉੱਥੋਂ ਦਾ ਮਾਹੌਲ ਜੋ ਹੈ ਬਹੁਤ ਸ਼ਾਂਤਮਈ ਬੜਾ ਅਨੰਦਮਈ ਹੈ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਮੈਂ ਆਪਣੇ ਜੰਮੂ ਦੇ ਵਿੱਚ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਗਏ ਸੀ ਉੱਥੋਂ ਦਾ ਜੋ ਮਾਹੌਲ ਹੈ ਬਹੁਤ ਅਨੰਦਮਈ ਬੜਾ ਸ਼ਾਂਤਮਈ ਹੈ ਲੋਕ ਉੱਥੇ ਪਹੁੰਚ ਕੇ ਕਟੜਾ ਤੋਂ ਜੰਮੂ ਤੋਂ ਕਟੜਾ ਜਾਂਦੇ ਹੈ ਤਾਂ ਉੱਥੇ ਪਹੁੰਚ ਕੇ ਜਦੋਂ ਫਿਰ ਉਹ ਆਪਣੀ ਚੜ੍ਹਾਈ ਸ਼ੁਰੂ ਕਰਦੇ ਹੈ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾ ਲਈ ਤਾਂ ਉਹ ਲੋਕ ਹਮੇਸ਼ਾ ਲੋਕ ਜੈ ਮਾਤਾ ਦੀ ਮਾਤਾ ਦੀ ਜੈਕਾਰੇ ਲਾਉਂਦੇ ਜਾਂਦੇ ਆ ਜਿਹੜਾ ਬੜਾ ਰੂਹ ਨੂੰ ਸਕੂਨ ਦੇਣ ਵਾਲਾ ਅਤੇ ਬੜਾ ਪਿਆਰਾ ਦ੍ਰਿਸ਼ ਹੁੰਦਾ ਤਾਂ ਉੱਥੋਂ ਦਾ ਜੋ ਮਾਹੌਲ ਹੁੰਦਾ ਜਦੋਂ ਅਸੀਂ ਉੱਪਰ ਚੜ੍ਹਾਈ ਵੱਲ ਜਾਂਦੇ ਹਾਂ ਤਾਂ ਸਾਨੂੰ ਪਹਾੜ ਦਿਸਦੇ ਹੈ ਅਸੀਂ ਪਹਾੜਾਂ ਦੇ ਉੱਪਰ ਜੋ ਹੈ ਯਾਤਰਾ ਕਰਨ ਜਾਂਦੇ ਐਂ ਤਾਂ ਉਸ ਦਾ ਮਾਹੌਲ ਜੋ ਹੈ ਬੜਾ ਅੱਛਾ ਮਹਿਸੂਸ ਹੁੰਦਾ ਅਤੇ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਮੈਂ ਜੈਸਲਮੇਰ ਗਿਆ ਸੀ ਜਿੱਥੇ ਕਿ ਬੜੇ ਅੱਛੇ ਡੈਜੇਟ ਮਾਰੂਥਲ ਹਨ ਬੜੇ ਅੱਛੇ ਦ੍ਰਿਸ਼ ਹੈ ਉੱਥੋਂ ਦੇ ਅਤੇ ਬਹੁਤ ਅੱਛੀਆਂ ਅੱਛੀਆਂ ਥਾਵਾਂ ਨੇ ਉਸ ਤੋਂ ਜੇ ਮੈਂ ਗੱਲ ਕਰਾਂ ਤਾਂ ਮੈਂ ਸ਼ਿਮਲੇ ਵੀ ਗਿਆ ਸੀ ਉੱਥੇ ਵੀ ਜੋ ਕਿ ਹੈ ਬਰਫਬਾਰੀ ਵਗੈਰਾ ਬਰਫ ਠੰਢਾ ਇਲਾਕਾ ਹੈ ਬਹੁਤ ਥਾਵਾਂ 'ਤੇ ਜਿੱਥੇ ਜਿੱਥੇ ਘੁੰਮਿਆ ਸਭ ਜਗ੍ਹਾ ਬਹੁਤ ਪਸੰਦ ਹੈ ਤਾਂ ਬੜੀਆਂ ਅੱਛੀਆਂ ਨੇ ਤਾਂ ਉਸ ਤੋਂ ਇਲਾਵਾ ਜਦੋਂ ਅਸੀਂ ਸਫਰ ਕਰਦੇ ਹਾਂ ਉਹਨਾਂ ਥਾਵਾਂ ਵੱਲ ਜਾਂਦੇ ਹਾਂ ਉਸ ਥਾਂ ਜਾਣ ਦੇ ਦੌਰਾਨ ਜੋ ਸਫਰ ਕਰਦੇ ਹੋ ਉਸ ਸਫਰ ਦਾ ਵੀ ਇੱਕ ਅਲੱਗ ਅਨੰਦ ਹੁੰਦਾ ਹੈ ਤਾਂ ਕਹਿ ਸਕਦੇ ਕਿ ਇਨਸਾਨ ਨੂੰ ਹਰ ਇੱਕ ਇਨਸਾਨ ਨੂੰ ਅਲੱਗ ਅਲੱਗ ਥਾਵਾਂ 'ਤੇ ਘੁੰਮਣਾ ਚਾਹੀਦਾ ਹੈ ਅਤੇ ਉੱਥੋਂ ਦਾ ਅਨੰਦ ਮਾਣਨਾ ਚਾਹੀਦਾ ਉੱਥੋਂ ਦੀਆਂ ਯਾਦਗਾਰ ਫੋਟੋਆਂ ਵੀ ਕਲਿੱਕ ਕਰਨੀਆਂ ਚਾਹੀਦੀਆਂ ਧੰਨਵਾਦ